ਮੈਂ ਵਿਜੇ ਗੁਰਦਾਸਪੁਰ ਜਿਲ੍ਹੇ ਦਾ ਵਾਸੀ ਹਾਂ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਬੈਂਕ ਵਾਲੇ ਜਿਸ ਤਰ੍ਹਾ ਮੈਨੂੰ ਦੱਸਿਆ ਕਿ ਤੁਹਾਡੇ ਆਧਾਰ ਕਾਰਡ ਦੇ ਗਲਤ ਵੇਰਵਿਆਂ ਕਾਰਨ ਤੁਹਾਡੀ ਸਭ ਸਿਟੀ ਦੀ ਪ੍ਰਕਿਰਿਆ ਨਹੀਂ ਕੀਤੀ ਜਾ ਰਹੀ ਤੇ ਮੈਂ ਇਕ ਇਸ ਗੱਲ ਦਾ ਯਕੀਨ ਦਿਲਾ ਰਿਹਾ ਹਾਂ ਕਿ ਮੈਂ ਬੈਂਕ ਤੋਂ ਬੈਂਕ ਨੂੰ ਆਪਣੇ ਆਧਾਰ ਕਾਰਡ ਨੂੰ ਠੀਕ ਕਰਾ ਕੇ ਤੇ ਇਸ ਦੀ ਸਹੀ ਜਾਣਕਾਰੀ ਤੁਹਾਨੂੰ ਉਪਲਬਧ ਕਰਵਾ ਦਿਆਂਗਾ ਥੋੜੇ ਹੀ ਦਿਨਾਂ ਦੀ ਮੋਹਲਤ ਮੈਨੂੰ ਦਿਓ ਤੇ ਮੈਂ ਅੱਜ ਹੀ ਆਪਣਾ ਪਤਾ ਜਾਂ ਜੋ ਇਸ ਵਿੱਚ ਗਲਤੀ ਦੀ ਗਲਤੀ ਹੈ ਮੈਂ ਉਸ ਨੂੰ ਸਮੇਂ ਦੇ ਮੁਤਾਬਿਕ ਠੀਕ ਕਰਵਾ ਕੇ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦਿੰਦਾ ਹਾਂ ਕਿ ਇਹ ਪੰਜ ਸੱਤ ਦਿਨਾਂ ਦੇ ਅੰਦਰ ਤੁਹਾਨੂੰ ਇਹ ਭੇਜਾਂਗਾ ਤਾਂ ਕਿ ਤੁਸੀਂ ਮੇਰੀ ਸਬਸਿਡੀ ਸਹੀ ਸਮੇਂ ਤੇ ਮੈਨੂੰ ਭੇਟ ਕਰ ਸਕੋ ਧੰਨਵਾਦ